ਹੈਲੋ ਹਾਂਜੀ ਗੁੱਡ ਈਵਨਿੰਗ ਜੀ ਮੈਂ ਕੈਨੇਡਾ ਤੋਂ ਆਈ ਹਾਂ ਅਤੇ ਮੈਂ ਪੰਜਾਬ ਦੇ ਬਾਰੇ ਕੁਛ ਜਾਣਨਾ ਚਾਹੁੰਦੀ ਹਾਂ ਮੈਨੂੰ ਐਕਚੁਲੀ ਪੰਜਾਬ ਦੇ ਬਾਰੇ ਕੁਛ ਪਤਾ ਨਹੀਂ ਹੈ ਕਾਂਇਡਲੀ ਗਾਈਡ ਕਰੋ ਮੈਨੂੰ ਮੈਂ ਪੰਜਾਬ ਦੀ ਜੋ ਫੇਮਸ ਫੇਮਸ ਚੀਜ਼ਾਂ ਆ ਜਿਵੇਂ ਕਿ ਫੁਲਕਾਰੀ ਜਾਂ ਪੰਜਾਬੀ ਸੂਟ ਸੂਟ ਸਲਵਾਰ ਇਹ ਸਭ ਚੀਜ਼ਾਂ ਪਰਚੇਸ ਕਰਨਾ ਚਾਹੁੰਦੀ ਹਾਂ ਅਤੇ ਮੈਨੂੰ ਕੋਈ ਰਸਤਿਆਂ ਦਾ ਨਹੀਂ ਪਤਾ ਅਤੇ ਪੰਜਾਬੀ ਜੁੱਤੀ ਵੀ ਲੈਣਾ ਚਾਹੁੰਦੀ ਹਾਂ ਅਤੇ ਮੈਨੂੰ ਗਾਈਡ ਕਰੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅਤੇ ਮੈਨੂੰ ਪੰਜਾਬੀ ਆਰਟੀਫਿਸ਼ਅਲ ਜਿਊਲਰੀ ਵੀ ਚਾਹੀਦੀ ਹੈ ਉਹ ਸਰ ਕਿਹੜੇ ਪਾਸੇ ਮਿਲੇਗੀ ਤਾਂ ਮੈਂ ਇਹ ਵੀ ਸੁਣਿਆ ਆ ਕਿ ਪੰਜਾਬ ਦਾ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਕਾਫੀ ਫੇਮਸ ਹੈ ਉਹ ਕਿੱਧਰੋਂ ਮਿਲੇਗਾ ਹਾਂਜੀ ਅਤੇ ਜੁੱਤੀ ਦੀ ਕੀਮਤ ਕਿੰਨੀ ਹੋਏਗੀ ਲਗਭਗ ਤਾਂ ਕਿਉਂਕਿ ਮੈਨੂੰ ਆਪਣੀ ਕਨਵਰਸੀ ਕਰੰਸੀ ਕਨਵਰਟ ਕਰਵਾਉਣੀ ਹੈ ਅਤੇ ਮੈਨੂੰ ਉਹਦੀ ਘੱਟੋ ਘੱਟ ਅਤੇ ਸਲਵਾਰ ਸੂਟ ਮਹਿੰਗੇ ਤੋਂ ਮਹਿੰਗਾ ਅਤੇ ਸਸਤੇ ਤੋਂ ਸਸਤੇ ਦਾ ਕੀ ਪ੍ਰਾਈਜ਼ ਹੈ ਅਤੇ ਕੱਪੜੇ ਦੇ ਵਿੱਚ ਕਿਹੜੀ ਕਿਹੜੀ ਵਰਾਇਟੀ ਹੈ ਸੂਟ ਸਲਵਾਰ ਦੇ ਵਿੱਚ ਅਤੇ ਨਾਲ ਫੁਲਕਾਰੀ ਦੁਪੱਟਾ ਮਿਲੇਗਾ ਕਿ ਨਹੀਂ ਅਤੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਸਰ